ਫੋਟੋਗ੍ਰਾਫਰੀ ਇੱਕ ਕਲਾ ਹੈ ਕਾਰਜ ਅਤੇ ਪ੍ਰਕਾਸ਼ ਨੂੰ ਰਿਕਾਰਡ ਕਰਕੇ ਚਿੱਤਰ ਬਣਾਉਣ ਦਾ ਅਭਿਆਸ ਹੈ ਜਾਂ ਤਾਂ ਇੱਕ ਚਿੱਤਰ ਸੰਖੇਪ ਦੁਆਰਾ ਲੇ ਇਲੈਕਟ੍ਰੋਨਿਕ ਤੌਰ 'ਤੇ ਜਾਂ ਰ ਰਸਾਇਣਿਕ ਤੌਰ 'ਤੇ ਸਮੱਗਰੀ ਜਿਵੇਂ ਕਿ ਫੋਟੋਗ੍ਰਾਫਰੀ ਫ਼ਿਲਮਾਂ ਦੁਆਰਾ ਇਹ ਵਿਗਿਆਨਿਕ ਨਿਰਵਾਨ ਅਤੇ ਕਾਰੋਬਾਰ ਦੇ ਬਹੁਤ ਸਾਰੇ ਖੇਤਰਾਂ ਵਿੱਚ ਕੰਮ ਕਰਦਾ ਹੈ ਨਾਲ ਹੀ ਇਹ ਕਲਾ ਫਿਲਮ ਅਤੇ ਵੀਡੀਓ ਵੀਡੀਓ ਉਪਦਾਨ ਮਨੋਰੰਜਨ ਦੇ ਮਨ ਮਨੋਰੰਜਨ ਦੇ ਉਪਦੇਸ਼ ਸ਼ੌਂਕ ਅਤੇ ਲਈ ਇਸ ਦੀ ਵਧੇਰੇ ਵਰਤੋਂ ਸਿੱਧੀ ਵਰਤੋਂ ਫੋਟੋਆਂ ਖਿੱਚਣ ਵਾਲੇ ਵਿਅਕਤੀ ਨੂੰ ਫੋਟੋਗ੍ਰਾਫਰ ਕਿਹਾ ਜਾਂਦਾ ਹੈ ਫੋਟੋਗ੍ਰਾਫਰ